ਅਸੀਂ ਬਾਗ ਵਿੱਚ ਉੱਗੇ ਫੁੱਲ ਜਿਹੜੇ ਅਸੀਂ ਸ਼ਹਿਰਾਂ ਦੇ ਵਿੱਚ ਲੈ ਕੇ ਜਾਂਦੇ ਹਾਂ ਵੇਚਣ ਵਾਸਤੇ ਸ਼ਹਿਰਾਂ ਪਿੰਡਾਂ ਥਾਵਾਂ ਗੱਡੀਆਂ ਨੂੰ ਸ਼ਿੰਗਾਰਨ ਵਾਸਤੇ ਅਤੇ ਸ਼ਹਿਰਾਂ 'ਚ ਘਰਾਂ ਨੂੰ ਸ਼ਿੰਗਾਰਨ ਵਾਸਤੇ ਗੁਰੂ ਘਰਾਂ ਨੂੰ ਮੰਦਿਰਾਂ ਦੇ ਵਿੱਚ ਵਰਤੋਂ ਵਾਸਤੇ ਜਿਹੜੇ ਫੁੱਲ ਹੈ ਅਤੇ ਉਹ ਮਤਲਬ ਉੱਥੇ ਵਰਤੇ ਜਾਂਦੇ ਹੈ ਅਤੇ ਅਸੀਂ ਇਹਨਾਂ ਦੀ ਸੇਲ ਕਰਦੇ ਹਾਂ ਜਾਂ ਅਸੀਂ ਇਹਨਾਂ ਨੂੰ ਤਿਆਰ ਕਰਕੇ ਹਾਰ ਵਗੈਰਾ ਅਤੇ ਉੱਥੇ ਜਿਹਨਾਂ ਨੂੰ ਜ਼ਰੂਰਤ ਹੁੰਦੀ ਹੈ ਜਿ ਉੱਥੇ ਅਸੀਂ ਪਰੋ ਦੇ ਕੇ ਆਉਂਦੇ ਹਾਂ ਅਤੇ ਫ਼ਲ ਹੈ ਜਿਹੜੇ ਕਿ ਫ਼ਲ ਹੈ ਜਿਹੜੇ ਉਹ ਅਸੀਂ ਕੁਛ ਘਰਾਂ 'ਚ ਵੀ ਵਰਤਦੇ ਹਾਂ ਅਤੇ ਇਹਨਾਂ ਨੂੰ ਫ਼ਲਾਂ ਨੂੰ ਤਾਂ ਖਾਣ ਵਾਸਤੇ ਵਰਤਿਆ ਜਾਣਾ ਹੈ ਅਤੇ ਕੁਛ ਫ਼ਲ ਅਸੀਂ ਸ਼ਹਿਰਾਂ 'ਚ ਵੇਚ ਆਉਂਦੇ ਹਾਂ ਅਤੇ ਇਹ ਸਾਡੀ ਕਮ ਕਮਾਈ ਦਾ ਸਾਧਨ ਵੀ ਆ ਫੁੱਲ ਅਤੇ ਫ਼ਲ ਜਿਹਨਾਂ ਤੋਂ ਅਸੀਂ ਆਰਖ ਅਸੀਂ ਆਰਥਿਕ ਤੌਰ 'ਤੇ ਥੋੜ੍ਹਾ ਮਜ਼ਬੂਤ ਹੋ ਜਾਂਦੇ ਹਾਂ ਸਾਡੀ ਇੱਕ ਕਮਾਈ ਹੋ ਜਾਂਦੀ ਹੈ ਸਾਡੇ ਖ਼ਰਚੇ ਵੀ ਪੂਰੇ ਹੋ ਜਾਂਦੇ ਹੈ ਅਤੇ ਅਸੀਂ ਆਪਣੀ ਮਿਹਨਤ ਵੀ ਕਰਦੇ ਰਹਿੰਦੇ ਹਾਂ ਅਤੇ ਸਾਨੂੰ ਕਮਾਈ ਵੀ ਹੁੰਦੀ ਹੈ ਇਹਦੇ ਤੋਂ